ਜੀ ਹਾਂ ਮੈਨੂੰ ਕਦੇ ਖਾਣਾ ਪਕਾਉਣ ਦੀ ਆਫ਼ਤ ਆਈ ਹੈ ਜਿਵੇਂ ਕਿ ਜਦੋਂ ਵੀ ਮੈਂ ਰੋਟੀਆਂ ਬਣਾਉਂਦੀ ਸੀ ਮੇਰੇ ਤੋਂ ਗਲਤੀ ਨਾਲ ਰੋਟੀਆਂ ਜਲ ਜਾਂਦੀਆਂ ਸੀ ਅਤੇ ਹੁਣ ਜਦੋਂ ਵੀ ਮੈਂ ਰੋਟੀ ਬਣਾਉਂਦੀ ਹਾਂ ਤਾਂ ਪਹਿਲਾਂ ਤਵੇ ਨੂੰ ਗਰਮ ਕਰਨ ਤੋਂ ਬਾਅਦ ਉਹਨੂੰ ਐਨ ਚੰਗੀ ਤਰ੍ਹਾਂ ਸਾਫ਼ ਕਰਕੇ ਫੇਰ ਮੈਂ ਰੋਟੀਆਂ ਪਕਾਉਂਦੀ ਹਾਂ